ਮੈਂ ਦਿਕਸ਼ਾ ਜ਼ਿਲ੍ਹਾ ਗੁਰਦਾਸਪੁਰ ਵਾਸੀ ਅੱਜ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਟੈਕਨੋਲਜੀ ਨੇ ਹੋਟਲ ਅਤੇ ਹੋਟਲ ਉਦਯੋਗ ਦੀ ਮਦਦ ਕਿਵੇਂ ਕੀਤੀ ਹੈ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਹਿਲੇ ਸਮੇਂ ਵਿੱਚ ਜਦੋਂ ਲੋਕ ਕਿਸੇ ਹੋਟਲ ਵਿੱਚ ਜਾਂਦੇ ਸੀ ਜੇਕਰ ਉਹਨਾਂ ਨੇ ਕਮਰਾ ਬੁੱਕ ਕਰਨਾ ਹੋਵੇ ਤਾਂ ਉਹ ਉੱਥੇ ਜਾ ਕੇ ਹੀ ਬੁਕਿੰਗ ਕਰਵਾਉਂਦੇ ਸਨ ਪਰ ਅੱਜ ਕੱਲ੍ਹ ਟੈਕਨੋਲੋਜੀ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਅਸੀਂ ਔਨਲਾਈਨ ਵੀ ਆਪਣੀ ਬੁਕਿੰਗ ਕਨਫਰਮ ਕਰ ਸਕਦੇ ਹਾਂ ਅਤੇ ਉਸ ਦੇ ਨਾਲ ਹੀ ਕੁਝ ਹੋਟਲਾਂ ਨੇ ਆਪਣੇ ਮੈਨੀਊ ਦਾ ਵੀ ਕਿਯੂ ਆਰ ਕੋਡ ਜੋ ਹੈ ਉਹ ਰੱਖਿਆ ਹੁੰਦਾ ਹੈ ਅਸੀਂ ਜਦੋਂ ਟੇਬਲ 'ਤੇ ਬੈਠਦੇ ਹਾਂ ਅਤੇ ਔਡਰ ਕਰਨ ਲਈ ਸਾਨੂੰ ਕਿਸੇ ਨੂੰ ਬੁਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਹੈ ਜੇਕਰ ਅਸੀਂ ਉਸ ਕਿਯੂ ਆਰ ਕੋਡ ਨੂੰ ਸਕੈਨ ਕਰਦੇ ਹਾਂ ਤਾਂ ਉਸ ਕਿਯੂ ਆਰ ਕੋਡ ਦੇ ਰਾਹੀਂ ਸਾਡੇ ਮੋਬਾਈਲ ਉੱਤੇ ਉਸ ਹੋਟਲ ਦਾ ਪੂਰਾ ਮੈਨੀਊ ਆ ਜਾਂਦਾ ਹੈ ਅਤੇ ਅਸੀਂ ਉਸ ਮੈਨੀਊ ਨੂੰ ਦੇਖ ਕੇ ਉਸ ਕਿਯੂ ਆਰ ਕੋਡ ਦੇ ਰਾਹੀਂ ਆਪਣਾ ਔਡਰ ਜੋ ਵੀ ਅਸੀਂ ਲੈਣਾ ਚਾਹੁੰਦੇ ਹਾਂ ਉਹ ਕਰ ਸਕਦੇ ਹਾਂ ਔਰ ਇਸ ਤੋਂ ਇਲਾਵਾ ਪੇਮੈਂਟ ਵਿੱਚ ਵੀ ਬਹੁਤ ਸਾਰੀ ਜਿਹੜੀਆਂ ਤਬਦੀਲੀਆਂ ਹੈ ਉਹ ਹੋਈਆਂ ਹਨ ਅਤੇ ਹੋਟਲ ਉਦਯੋਗ ਵਿੱਚ ਇਸ ਤਰ੍ਹਾਂ ਜੋ ਹੈ ਟੈਕਨੋਲਜੀ ਨੇ ਮਦਦ ਕੀਤੀ ਹੈ ਜਿਸ ਨਾਲ ਲੋਕਾਂ ਨੂੰ ਬਹੁਤ ਸਹੂਲਤਾਂ ਪ੍ਰਾਪਤ ਹੋਈਆਂ ਹਨ ਉਹਨਾਂ ਨੂੰ ਵੇਟਿੰਗ ਨਹੀਂ ਕਰਨੀ ਪੈਂਦੀ ਅਤੇ ਸਮੇਂ ਸਿਰ ਉਹਨਾਂ ਨੂੰ ਆਪਣੀ ਬੁਕਿੰਗ ਜੋ ਹੈ ਉਹ ਮਿਲ ਜਾਂਦੀ ਹੈ ਧੰਨਵਾਦ